ਹੈਲੋ ਸਰ ਮੈਂ ਤੁਹਾਡੀ ਫਰਮ ਤੋਂ ਤਿੰਨ ਚਾਰ ਮਹੀਨੇ ਪਹਿਲਾਂ ਸ਼ੈਂਪੂ ਖਰੀਦਿਆ ਸੀ ਇਹ ਸ਼ੈਂਪੂ ਮੈਨੂੰ ਮੇਰੀ ਸਹੇਲੀ ਨੇ ਸਜੈਸਟ ਕੀਤਾ ਸੀਗਾ ਕਿਉਂਕਿ ਉਹ ਕਾਫ਼ੀ ਸਮੇਂ ਤੋਂ ਇਸ ਦੀ ਵਰਤੋਂ ਕਰ ਰਹੀ ਹੈ ਉਸ ਨੇ ਤਾਂ ਇਸ ਸ਼ੈਂਪੂ ਦੀਆਂ ਇੰਨੀਆਂ ਤਾਰੀਫ਼ਾਂ ਕੀਤੀਆਂ ਕਿ ਮੇਰਾ ਵੀ ਦਿਲ ਕਰੇ ਕਿ ਮੈਂ ਵੀ ਇਹ ਸ਼ੈਂਪੂ ਹੁਣ ਹੀ ਓਡਰ ਕਰ ਦੇਵਾਂ ਤਾਂ ਉਸ ਦੀਆਂ ਗੱਲਾਂ ਵਿੱਚ ਆ ਕੇ ਮੈਂ ਇਹ ਸ਼ੈਂਪੂ ਮੰਗਵਾਇਆ ਜਦੋਂ ਮੈਂ ਪਹਿਲੀ ਵਾਰੀ ਸ਼ੈਂਪੂ ਮੰਗਵਾਇਆ ਉਹ ਸ਼ੈਂਪੂ ਤਾਂ ਚਲੋ ਮੈਨੂੰ ਕ ਕਹਿ ਲਓ ਥੋੜ੍ਹਾ ਫ਼ਰਕ ਲੱਗਾ ਕਿ ਮੇਰੇ ਵਾਲਾਂ ਦੇ ਵਿੱਚ ਥੋੜ੍ਹੀ ਸ਼ਾਈਨ ਆ ਗਈ ਮੇਰੇ ਵਾਲ ਜਿਹੜੇ ਹਲਕੇ ਜਿਹੇ ਝੜ ਰਹੇ ਸੀ ਉਹ ਵੀ ਠੀਕ ਹੋ ਗਏ ਠੀਕ ਹੈ ਤਾਂ ਮੈਨੂੰ ਲੱਗਾ ਕਿ ਕਾਫ਼ੀ ਚੰਗਾ ਪ੍ਰੋਡਕਟ ਹੈ ਪਰ ਦੂਜੀ ਵਾਰੀ ਜਦੋਂ ਮੈਂ ਹੁਣ ਪਿਛਲੇ ਮਹੀਨੇ ਸ਼ੈਂਪੂ ਮੰਗਵਾਇਆ ਤਾਂ ਜਦੋਂ ਤੋਂ ਮੈਂ ਇਸ ਦੀ ਵਰਤੋਂ ਸ਼ੁਰੂ ਕੀਤੀ ਹੈ ਉਦੋਂ ਤੋਂ ਹੀ ਮੇਰੇ ਵਾਲ ਜਿਹੜੇ ਨੇ ਇੰਨੇ ਜ਼ਿਆਦਾ ਝੜਨੇ ਸ਼ੁਰੂ ਹੋ ਗਏ ਨੇ ਪਰ ਮੈਂ ਸੋਚਿਆ ਸ਼ਾਇਦ ਇੱਕ ਦੋ ਵ ਵਾਰ ਵਰਤੋਂ ਕਰਨ ਤੋਂ ਬਾਅਦ ਸ਼ਾਇਦ ਇਹਦਾ ਜਿਹੜਾ ਕਿਸੇ ਪ੍ਰੋਡਕਟ ਦਾ ਅਸਰ ਹੁੰਦਾ ਹੈ ਤਾਂ ਮੈਂ ਇਹ ਨੂੰ ਵਰਤਣਾ ਕੰਟੀਨਿਊ ਕੀਤਾ ਪਰ ਹੁਣ ਇਸ ਨੂੰ ਵਰਤਦੇ ਹੋਏ ਮੈਨੂੰ ਚਾਰ ਹਫ਼ਤੇ ਹੋ ਗਏ ਨੇ ਹੁਣ ਇਸ ਸ਼ੈਂਪੂ ਨੇ ਤਾਂ ਮੇਰੇ ਵਾਲਾਂ 'ਚੋਂ ਅ ਵਾਲਾਂ ਨੂੰ ਇੰਨਾ ਜ਼ਿਆਦਾ ਝਾੜ ਦਿੱਤਾ ਹੈ ਕਿ ਵਾਲ ਜੜ੍ਹਾਂ ਤੋਂ ਹੀ ਪੂਰੇ ਦੇ ਪੂਰੇ ਉਤਰਦੇ ਨੇ ਇਸ ਤੋਂ ਇਲਾਵਾ ਇਸ ਸ਼ੈਂਪੂ ਦੀ ਵਰਤੋਂ ਕਾਰਨ ਮੇਰੇ ਵਾਲ ਜਿਹੜੇ ਨੇ ਇੰਨੇ ਜ਼ਿਆਦਾ ਰੁੱਖੇ ਹੋ ਗਏ ਨੇ ਕਿ ਉਹਨਾਂ ਨੂੰ ਸੁਲਝਾਉਣਾ ਜਿਹੜਾ ਹੈ ਐਡਾ ਔਖਾ ਹੁੰਦਾ ਹੈ ਕਿ ਸਾਰਾ ਦਿਨ ਉਹ ਉਲਝੇ ਹੀ ਰਹਿੰਦੇ ਨੇ ਜਿੰਨੀ ਮਰਜ਼ੀ ਕੰਘੀ ਨਾਲ ਸੁਲਝਾ ਲਓ ਉਹਨਾਂ 'ਚੋਂ ਗੁੰਝਲਾਂ ਜਿਹੜੀਆਂ ਹੈ ਖ਼ਤਮ ਹੀ ਨਹੀਂ ਹੁੰਦੀਆਂ ਅਤੇ ਵੇਖਣ ਦੇ ਵਿੱਚ ਵੀ ਵਾਲ ਜਿਹੜੇ ਨੇ ਬਹੁਤ ਹੀ ਜ਼ਿਆਦਾ ਭੈੜੇ ਲੱਗਦੇ ਨੇ ਹੋਰ ਤਾਂ ਹੋਰ ਇਸ ਸ਼ੈਂਪੂ ਦੀ ਵਰਤੋਂ ਨਾਲ ਮੇਰੇ ਵਾਲਾਂ ਦੀ ਜਿਹੜੀ ਕੁਦਰਤੀ ਚਮਕ ਸੀਗੀ ਉਹ ਵੀ ਜਾਂਦੀ ਰਹੀ ਵਾਲ ਹੁਣ ਬਹੁਤ ਹੀ ਰੁੱਖੇ ਸੁੱਖੇ ਜਿਹੇ ਨਜ਼ਰ ਆਉਂਦੇ ਨੇ ਅਤੇ ਉਹ ਮੈਨੇਜ ਨਹੀਂ ਲੱਗਦੇ ਹੈਗੇ ਸਰ ਆਪ ਨੂੰ ਆਪਣੇ ਪ੍ਰੋਡਕਟ ਦੀ ਜਿਹੜੀ ਗੁਣਵੱਤਾ ਵੱਲ ਧਿਆਨ ਦੇਣਾ ਚਾਹੀਦਾ ਹੈ ਜੇ ਗਾਹਕ ਕੋਈ ਇਹਨੂੰ ਖਰੀਦਦਾ ਆ ਤਾਂ ਉਹਨਾਂ ਦੇ ਪੈਸੇ ਜਿਹੜੇ ਆ ਵਸੂਲ ਹੋਣੇ ਚਾਹੀਦੇ ਹੈ ਕਸਟਮਰਜ਼ ਨੂੰ ਮੇਰੇ ਵਾਂਗ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪੈਣਾ ਚਾਹੀਦਾ ਤੁਸੀਂ ਆਪਣੇ ਪ੍ਰੋਡਕਟ ਦੀ ਕੁਆਲਟੀ ਵਿੱਚ ਸੁਧਾਰ ਕਰੋ ਅਤੇ ਮੈਂ ਇਹ ਸ਼ੈਂਪੂ ਤੁਹਾਨੂੰ ਵਾਪਸ ਭੇਜ ਰਹੀ ਹਾਂ ਅਤੇ ਮੈਨੂੰ ਇਸ ਦੀ ਕੀਮਤ ਜਿਹੜੀ ਹੈ ਵਾਪਸ ਅਦਾ ਕੀਤੀ ਜਾਵੇ ਧੰਨਵਾਦ